ਅਸੀਂ ਇੱਕਵੀਂ ਸਦੀ ਵਿੱਚ ਰਹਿ ਰਹੇ ਹਾਂ ਇੱਥੇ ਸਾਨੂੰ ਹਰ ਇੱਕ ਚੀਜ਼ ਬੜੀ ਜਲਦੀ ਲੱਭ ਜਾਂਦੀ ਹੈ ਜਿਵੇਂ ਕਿ ਘੁੰਮਣ ਦੀ ਗੱਲ ਕਰੀਏ ਅੱਗੇ ਤਾਂ ਬੱਸਾਂ ਵਿੱਚ ਜਾਣਾ ਪੈਂਦਾ ਸੀ ਪਰ ਅੱਜ ਕੱਲ ਉਬਰ ਜਾਂ ਓਲਾ ਵਰਗੇ ਮੋਟਰ ਵਾਹਨ ਆ ਗਏ ਹਨ ਜਿਸ ਨਾਲ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜਿਸ ਨੂੰ ਅਸੀਂ ਘਰ ਬੈਠੇ ਹੀ ਮੰਗਵਾ ਸਕਦੇ ਹਾਂ ਅਸੀਂ ਹਮੇਸ਼ਾ ਉਬਰ ਬੁੱਕ ਕਰਦੇ ਹਾਂ ਜਿਸ ਕਰਕੇ ਸਾਨੂੰ ਕਈ ਵਾਰ ਛੂਟ ਮਿਲ ਜਾਂਦੀ ਹੈ ਹੁਣ ਅਸੀਂ ਸਾਰੇ ਘੁੰਮਣ ਬਾਰੇ ਸੋਚ ਰਹੇ ਹਾਂ ਦੋਸਤ ਅਤੇ ਫੈਮਲੀ ਮੈਂਬਰ ਅਸੀਂ ਤੁਹਾਡੇ ਉਬਰ ਬੁੱਕ ਕਰਾਂਗੇ ਅਤੇ ਸਾਨੂੰ ਇਸ 'ਤੇ ਛੂਟ ਦਿੱਤੀ ਜਾਵੇ ਜਿਵੇਂ ਖਰਚਾ ਸੱਤ ਹਜ਼ਾਰ ਦਾ ਹੋਵੇ ਤਾਂ ਸਾਨੂੰ ਪੰਦਰ੍ਹਾਂ ਸੌ ਦੀ ਛੂਟ ਦਿੱਤੀ ਜਾਵੇ ਜਾਂ ਸਾਨੂੰ ਕੋਈ ਪਰੋਮੋ ਕੋਡ ਦਿੱਤਾ ਜਾਵੇ ਜਿਸ ਨਾਲ ਛੂਟ ਮਿਲੇ ਅਸੀਂ ਤੁਹਾਡੇ ਰੈਗੂਲਰ ਕਸਟਮਰ ਹਾਂ ਅਤੇ ਤੁਹਾਡੀ ਸਰਵਿਸ ਸਾਨੂੰ ਬਹੁਤ ਵਧੀਆ ਹੈ